ਹਾਂਜੀ ਅਸੀਂ ਬਾਹਰੋਂ ਆਏ ਹਾਂ ਜੀ ਘੁੰਮਣ ਲਈ ਤੁਹਾਡਾ ਫੋਨ ਨੰਬਰ ਸਾਨੂੰ ਮਿਲਿਆ ਅਤੇ ਅਸੀਂ ਤੁਹਾਡੇ ਇਹ ਪੁੱਛਣਾ ਚਾਹੁੰਦੇ ਹਾਂ ਬਈ ਇਥੋਂ ਦਾ ਮਾਘੀ ਮੇਲਾ ਕਿਵੇਂ ਮਨਾਇਆ ਜਾਂਦਾ ਔਰ ਵੈਸੇ ਤਾਂ ਅਸੀਂ ਮਾਘੀ 'ਤੇ ਹੀ ਆਉਣਾ ਸੀ ਸਾਨੂੰ ਪਹਿਲਾਂ ਵੀ ਆਉਣਾ ਪੈ ਗਿਆ ਠੀਕ ਹੈ

ਹਾਂਜੀ ਹਾਂਜੀ ਅੱਛਾ

ਅੱਛਾ ਠੀਕ ਹੈ ਠੀਕ ਹੈ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਹਾਂ ਹਾਂ ਹਾਂ ਹਾਂ ਹਾਂ ਠੀਕ ਹੈ ਠੀਕ ਹੈ

ਹਾਂ ਹਾਂ

ਅੱਛਾ ਅੱਛਾ ਠੀਕ ਹੈ ਜੀ ਅਤੇ ਅੱਛਾ ਜੀ ਉਹ ਕਿੰਨੇ ਦਿਨ ਚਲਦੀ ਹੈ ਜੀ ਹਾਂ ਹਾਂ ਘੜਦੌੜ ਤਾਂ ਘੜਦੌੜ ਲੋਕ ਦੇਖਣ ਬਹੁਰੋ ਬਹੁਤ ਦੂਰੋਂ ਦੂਰੋਂ ਆਉਂਦੇ ਹੋਣਗੇ ਉਹ ਅੱਛਾ ਅੱਛਾ ਜੀ ਸ਼ੁਕਰੀਆ ਤੁਹਾਡਾ ਮਿਹਰਬਾਨੀ ਬਹੁਤ ਬਹੁਤ